ਮੈਨੂੰ ਸਭ ਤੋਂ ਜ਼ਿਆਦਾ ਮਾਣ ਆਪਣੇ ਉੱਤੇ ਇਸੇ ਚੀਜ਼ ਦਾ ਹੈ ਕਿ ਮੈਂ ਹਮੇਸ਼ਾਂ ਸੱਚ ਬੋਲਦਾਂ ਅਤੇ ਮੈਂ ਕੋਈ ਵੀ ਨਸ਼ਾ ਪੱਤਾ ਨਹੀਂ ਕਰਦਾਂ ਅਤੇ ਲੋਕ ਮੇਰੇ ਉੱਤੇ ਵਿਸ਼ਵਾਸ ਬਹੁਤ ਛੇਤੀ ਕਰ ਲੈਂਦੇ ਹਨ ਅਤੇ ਓਹਨਾ ਦਾ ਵਿਸ਼ਵਾਸ ਮੇਰੇ ਉੱਤੇ ਬਣਿਆ ਰਹਿੰਦਾ ਹੈ ਮੈਂ ਇਹੀ ਕਹਿੰਦਾ ਹਾਂ ਵੀ ਕੋਈ ਵੀ ਬੰਦਾ ਜਿਹੜਾ ਵੀ ਝੂਠ ਪਰ ਨਾ ਚੱਲੇ ਸੱਚ ਬੋਲੇ ਅਤੇ ਸੱਚ ਬੋਲਣੇ ਨਾਲ ਕਿਆ ਏ ਕਿ ਸਾਨੂੰ ਔਕੜਾਂ ਤਾਂ ਬਹੁਤ ਆਉਂਦੀਆ ਪਰ ਕਦੇ ਵੀ ਮਤਲਬ ਕਿ ਤੁਸੀਂ ਦੁਖੀ ਨਹੀਂ ਹੁੰਦੇ ਕੋਈ ਪਛਤਾਵਾ ਨਹੀਂ ਹੁੰਦਾ ਤੁਹਾਨੂੰ ਅਤੇ ਤੁਸੀਂਂ ਹਮੇਸ਼ਾਂ ਮਾਣ ਮਹਿਸੂਸ ਕਰਦੇ ਹੋ ਔਕੜਾਂ ਜ਼ਰੂਰ ਆਉਂਦੀਆਂ ਪਰ ਸੱਚਾਈ ਦੀ ਰਾਹ ਬਹੁਤ ਚੰਗੀ ਹੁੰਦੀ ਹੈ ਅਤੇ ਹਮੇਸ਼ਾਂ ਸਾਨੂੰ ਸੱਚ ਵੱਲ ਤੁਰਨਾ ਚਾਹੀਦਾ ਹੈ ਅਤੇ ਇਮਾਨਦਾਰੀ ਬਣਾ ਕੇ ਰੱਖਣੀ ਚਾਹੀਦੀ ਹੈ ਇਹ ਜਿਹੜਾ ਵਿਸ਼ਵਾਸ ਬਣ ਜਾਂਦਾ ਹੈ ਇਹ ਬਹੁਤ ਜ਼ਰੂਰੀ ਹੈ ਅਤੇ ਇਸਦਾ ਹੀ ਮਾਣ ਸਭ ਤੋਂ ਜ਼ਿਆਦਾ ਆਉਂਦਾ ਹੈ ਮੈਂ ਤਾਂ ਇਹੀ ਕਹੂੰਗਾ ਵੀ ਸਭ ਸੱਚ ਦੇ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਨ